ਮੈਂ ਤਰਨ ਤਾਰਨ ਵਿੱਚ ਰਹਿਣ ਵਾਲੀ ਹਾਂ ਕੁਛ ਦਿਨ ਤੋਂ ਮੇਰੇ ਘਰ ਮੇਰੇ ਰਿਸ਼ਤੇਦਾਰ ਆਏ ਹੋਏ ਸਨ ਅਸੀਂ ਇੱਕ ਬਾਹਰ ਜਾਣ ਲਈ ਯਾਤਰਾ ਕਰਨ ਲਈ ਆਪਸ ਵਿੱਚ ਮਸ਼ਵਰਾ ਕੀਤਾ ਅਸੀਂ ਇੱਕ ਯਾਤਰਾ 'ਤੇ ਚੱਲਾਂਗੇ ਸਾਡੇ ਅਸੀਂ ਟੋਟਲ ਚਾਰ ਮੈਂਬਰ ਸਨ ਔਰ ਮੇਰੇ ਰਿਸ਼ਤੇਦਾਰ ਛੇ ਮੈਂਬਰ ਹੋਰ ਸਨ ਅਸੀਂ ਟੋਟਲ ਦਸ ਮੈਂਬਰ ਸੀ ਸਾਨੂੰ ਇੱਕ ਵੱਡੀ ਕੈਬ ਔਰ ਇੱਕ ਛੋਟੀ ਕੈਬ ਚਾਹੀਦੀ ਸੀ ਅਸੀਂ ਓਲਾਂ 'ਤੇ ਕੈਬ ਬੁੱਕ ਕੀਤੀ ਔਰ ਉਹਨਾਂ ਨੂੰ ਪੁੱਛਿਆ ਕਿ ਛੋਟੀ ਕੈਬ ਦਾ ਕੀ ਰੇਟ ਹੈ ਔਰ ਵੱਡੀ ਕੈਬ ਦਾ ਕੀ ਰੇਟ ਹੈ ਅਸੀਂ ਤਰਨ ਤਾਰਨ ਤੋਂ ਬਾਬਾ ਬੁੱਢਾ ਸਾਹਿਬ ਨੂੰ ਜਾਣਾ ਸੀ ਅਸੀਂ ਉਹਨਾਂ ਨੂੰ ਫੋਨ ਕੀਤਾ ਕੈਬ ਵਾਲਿਆਂ ਨੂੰ ਕਿ ਸਾਨੂੰ ਕਿਹੜੀ ਕਿਸ ਮਤਲਬ ਛੋਟੀ ਕੈਬ ਔਰ ਵੱਡੀ ਕੈਬ ਦੋ ਕੈਬ ਚਾਹੀਦੀਆਂ ਹੈ ਕਿਉਂਕਿ ਸਾਡੇ ਅਸੀਂ ਟੋਟਲ ਦਸ ਮੈਂਬਰ ਹਾਂ ਇਸ ਕਰਕੇ ਇੱਕ ਇੱਕ ਕੈਬ ਵਿੱਚ ਮੈਂਬਰ ਪੂਰੇ ਨਹੀਂ ਹੋਣੇ ਇਸ ਕਰਕੇ ਸਾਨੂੰ ਦੋਨਾਂ ਕੈਬਾਂ ਦਾ ਅਲੱਗ ਅਲੱਗ ਰੇਟ ਦੱਸੋ ਅਤੇ ਕਿਹੜੀ ਸਾਨੂੰ ਕੈਬ ਫਿੱਟ ਕਰੇਗੀ ਜੇ ਦੋਵੇਂ ਛੋਟੀਆਂ ਕੈਬ ਹੀ ਮਤਲਬ ਅਸੀਂ ਮੈਂਬਰ ਪੂਰੇ ਹੋ ਜਾਵਾਂਗੇ ਤਾਂ ਵੀ ਉਸ ਦਾ ਵੀ ਰੇਟ ਅਲੱਗ ਦੱਸੋ ਔਰ ਜੇ ਵੱਡੀ ਵਿੱਚ ਅਸੀਂ ਸਾਰੇ ਹੋ ਸਕਦੇ ਹਾਂ ਅਤੇ ਤਾਂ ਉਸਦਾ ਵੀ ਰੇਟ ਦੱਸੋ ਅਸੀਂ ਆਪਾਂ ਮਤਲਬ ਬਾਬਾ ਬੁੱਢਾ ਸਾਹਿਬ ਜਾਣਾ ਹੈ ਸਾਨੂੰ ਰੇਟਾਂ ਬਾਰੇ ਪੂਰੀ ਜਾਣਕਾਰੀ ਦਿਓ ਕਿ ਅਸੀਂ ਜੋ ਵੀ ਸਾਨੂੰ ਅੱਛਾ ਲੱਗੇ ਵਧੀਆ ਲੱਗੇ ਅਸੀਂ ਉਹ ਕੈਬ ਫਿ ਮਤਲਬ ਕੈਬ ਨੂੰ ਔਡਰ ਕਰ ਕਰਾਂਗੇ ਧੰਨਵਾਦ